ਮੈਂ ਅੱਜ ਤੁਹਾਨੂੰ ਦੱਸਣਾ ਚਾਹਾਂਗਾ ਅੋਟੋਮੈਟਿਵ ਅਨੁਵਾਦ ਨੂੰ ਲੈ ਕੇ ਜਾਂ ਗੂਗਲ ਮੈਪਸ ਨੂੰ ਲੈ ਕੇ ਇਹ ਵੀ ਇੱਕ ਟੈਕਨੋਲੋਜੀ ਦੀ ਵਰਤੋਂ ਹੀ ਹੈ ਜੋ ਕਿ ਜੀਵਨ ਪੱਧਰ 'ਤੇ ਆਪਾਂ ਨੂੰ ਇੱਕ ਸੁਖਾਲਾ ਬਣਾਉਂਦੀ ਹੈ ਸੁਖਾਲਾ ਕਿਵੇਂ ਬਣਾਉਂਦੀ ਹੈ ਮੈਂ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਵਾਂ ਗੂਗਲ ਮੈਪਸ ਨੂੰ ਲੈ ਕੇ ਜਦੋਂ ਪਹਿਲਾਂ ਗੂਗਲ ਮੈਪਸ ਨਹੀਂ ਹੁੰਦੇ ਸੀ ਆਪਾਂ ਨੇ ਕਿਤੇ ਜਾਣਾ ਹੁੰਦਾ ਸੀ ਤਾਂ ਆਪਾਂ ਨੂੰ ਦਸ ਲੋਕਾਂ ਤੋਂ ਪੁੱਛਣਾ ਪੈਂਦਾ ਸੀ ਫਿਰ ਕਈ ਵਾਰ ਆਪਾਂ ਜੇਕਰ ਬਾਹਰ ਗਏ ਹਾਂ ਤਾਂ ਬਾਹਰ ਜਦੋਂ ਜਾਂਦੇ ਸੀ ਆਪਾਂ ਤਾਂ ਆਪਾਂ ਨੂੰ ਪੁੱਛ ਪੁੱਛ ਕੇ ਜਾਣਾ ਪੈਂਦਾ ਸੀ ਵੀ ਅਸੀਂ ਕਿੱਥੇ ਜਾਣਾ ਕਈ ਵਾਰ ਲੋਕ ਰਾਹ ਭਟਕ ਜਾਂਦੇ ਸੀ ਅਤੇ ਰਾਹ ਭਟਕਦੇ ਭਟਕਦੇ ਕਈ ਜਿੱਥੇ ਆਪਾਂ ਨੂੰ ਕਿਸੇ ਕਿਤੇ ਜਾਣ ਲਈ ਦੋ ਘੰਟੇ ਲੱਗਣੇ ਆ ਉੱਥੇ ਆਪਾਂ ਰਾਹ ਭਟਕਣ ਕਰਕੇ ਚਾਰ ਘੰਟੇ ਜਾਂ ਪੰਜ ਘੰਟੇ ਲੱਗ ਜਾਂਦੇ ਸੀ ਜੇਕਰ ਕਿਸੇ ਵਾਰੀ ਐਮਰਜੈਂਸੀ ਹੈ ਮੀਟਿੰਗ 'ਚ ਜਾਣਾ ਤਾਂ ਆਪਾਂ ਨੂੰ ਰਾਹ ਕਰ ਰਾਹ ਕਰਕੇ ਆਪਾਂ ਨੂੰ ਉਸ ਮੀਟਿੰਗ ਤੋਂ ਲੇਟ ਹੋ ਜਾਂਦੇ ਸੀ ਜਾਂ ਆਪਣੀ ਟ੍ਰੇਨ ਨਿਕਲ ਜਾਂਦੀ ਸੀ ਬਟ ਹੁਣ ਟੈਕਨੋਲਜੀ ਜਿਵੇਂ ਜਿਵੇਂ ਵਧੀ ਹੈ ਉਵੇਂ ਉਵੇਂ ਆਪਾਂ ਇੱਕ ਚੀਜ਼ ਨੋਟ ਕੀਤੀ ਹੈ ਬਈ ਗੂਗਲ ਮੈਪਸ ਆਏ ਗੂਗਲ ਮੈਪ ਦਾ ਕੀ ਫਾਇਦਾ ਹੋ ਗਿਆ ਆਪਾਂ ਨੂੰ ਇਸ ਦੇ ਨਾਲ ਆਪਾਂ ਨੂੰ ਸੈਟਲਾਈਟ ਦੇ ਰਾਹੀਂ ਆਪਾਂ ਨੂੰ ਇਹ ਪਤਾ ਲੱਗਣ ਲੱਗ ਗਿਆ ਜਿੱਥੇ ਵੀ ਆਪਾਂ ਜਾਣਾ ਆਪਾਂ ਆਪਣੇ ਮੋਬਾਈਲ 'ਚ ਲੋਕੇਸ਼ਨ ਆਪਣੀ ਕਰੰਟ ਲੋਕੇਸ਼ਨ ਭਰ ਸਕਦੇ ਹਾਂ ਅਤੇ ਜਿੱਧਰ ਆਪਾਂ ਜਾਣਾ ਉਸ ਦੀ ਲੋਕੇਸ਼ਨ ਭਰ ਸਕਦੇ ਹਾਂ ਉਹ ਆਪਾਂ ਨੂੰ ਬੜੇ ਸੌਖੇ ਢੰਗ ਨਾਲ ਵੀ ਕਿੰਨੇ ਕਿਲੋਮੀਟਰ ਹੈ ਕਿੰਨਾ ਟਾਈਮ ਲੱਗੇਗਾ ਇਹ ਮਤਲਬ ਗੂਗਲ ਮੈਪਸ ਦਾ ਇੰਨਾ ਕੁ ਚੀਜ਼ ਦੱਸਦਾ ਪਿਆ ਆਪਾਂ ਨੂੰ ਕਿ ਤੁਹਾਨੂੰ ਜਿਹੜੀ ਸੜਕ ਤੋਂ ਤੁਸੀਂ ਜਾ ਰਹੇ ਹੋ ਉੱਥੇ ਤੁਹਾਨੂੰ ਟਰੈਫਿਕ ਮਿਲੇਗਾ ਕਿ ਨਹੀਂ ਮਿਲੇਗਾ ਅਗਰ ਉੱਥੇ ਕੋਈ ਐਕਸੀਡੈਂਟ ਵੀ ਹੋਇਆ ਤਾਂ ਵੀ ਉਹ ਤੁਹਾਨੂੰ ਗੂਗਲ ਮੈਪ ਦੱਸਦਾ ਇਸ ਤੋਂ ਇਲਾਵਾ ਜੇਕਰ ਆਪਾਂ ਆਟੋਮੈਟਿਕ ਅਨੁਵਾਦ ਅਨੁਵਾਦ ਦੀ ਗੱਲ ਕਰੀਏ ਇਹ ਵੀ ਇੱਕ ਬਹੁਤ ਵੱਡੀ ਸਹੂਲਤ ਦਿੱਤੀ ਹੈ ਟੈਕਨੋਲੋਜੀ ਦੀ ਸਹੂਲਤ ਹੈ ਕੋਈ ਵੀ ਚੀਜ਼ ਆਪਾਂ ਇੰਗਲਿਸ਼ 'ਚ ਜੇ ਮੈਂ ਆਪ ਦੀ ਗੱਲ ਕਰਾਂ ਕੋਈ ਵੀ ਮੈਨੂੰ ਕਿਤਾਬ ਤੋਂ ਕਈ ਵਾਰੀ ਮੈਨੂੰ ਪੰਜਾਬੀ ਦਾ ਵਰਡ ਹੋ ਗਿਆ ਜਾਂ ਇੰਗਲਿਸ਼ ਦਾ ਵਰਡ ਸਮਝ ਨਹੀਂ ਆਉਂਦਾ ਤਾਂ ਮੈਂ ਆਪਣੀ ਪੰਜਾਬੀ ਭਾਸ਼ਾ ਦੇ ਵਿੱਚ ਉਸਨੂੰ ਗੂਗਲ 'ਤੇ ਲਿਖ ਕੇ ਅਨੁਵਾਦ ਕਰ ਲੈਂਦਾ ਹਾਂ ਜੋ ਕਿ ਬਹੁਤ ਵਧੀਆ ਤਰੀਕਾ ਹੈ ਸਮਝਣ ਦਾ ਠੀਕ ਹੈ ਨਹੀਂ ਤਾਂ ਜੇ ਜਦੋਂ ਪਹਿਲਾਂ ਇਹ ਚੀਜ਼ ਨਹੀਂ ਸੀ ਆਪਾਂ ਨੂੰ ਖੁਦ ਡਿਕਸ਼ਨਰੀ ਤੋਂ ਲੈ ਕੇ ਐਡੀਆਂ ਮੋਟੀਆਂ ਮੋਟੀਆਂ ਡਿਕਸ਼ਨੀਆਂ ਫਰੋਲਣੀਆਂ ਪੈਂਦੀਆਂ ਸੀ ਉਹਦਾ ਅਨੁਵਾਦ ਲੱਭਣਾ ਪੈਂਦਾ ਸੀ ਬਟ ਹੁਣ ਟੈਕਨੋਲਜੀ ਕਰਕੇ ਆਪਾਂ ਉਸ ਚੀਜ਼ ਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਕਰ ਜਾਂਦੇ ਹਾਂ ਤਾਂ ਮੇਰੇ ਅਕੋਰਡਿੰਗ ਆਹ ਚੀਜ਼ਾਂ ਸਹੀ ਹਨ ਟੈਕਨੋਲਜੀ ਅਗਰ ਆਪਾਂ ਸਦ ਉਪਯੋਗ ਕਰ ਰਹੇ ਹਾਂ ਸਹੀ ਤਰੀਕੇ ਨਾਲ ਕਰ ਰਹੇ ਹਾਂ ਤਾਂ ਉਹ ਚੀਜ਼ ਸਹੀ ਹੈ